ਹੈਲੋ

ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇੰਦਰਜੀਤ ਸਿੰਘ ਹੈ ਜੀ ਅਤੇ ਮੇਰਾ ਯੂਟੀਊਬ 'ਤੇ ਇੱਕ ਚੈੱਨਲ ਹੈ ਜੀ ਜਿਸ ਵਿੱਚ ਮੈਂ ਪੰਜਾਬ ਦੇ ਜਿਹੜੇ ਮਸ਼ਹੂਰ ਮਿਠਿਆਈ ਦੀਆਂ ਦੁਕਾਨਾਂ ਹੈ ਜੀ ਉਹਨਾਂ ਦੇ ਬਾਰੇ ਯੂਟੀਊਬ ਮੇਰੀ ਆਪਣੀ ਜਿਹੜੀ ਯੂਟੀਊਬ ਫੈਮਲੀ ਹੈ ਜੀ ਉਹਨਾਂ ਨੂੰ ਜਾਣਕਾਰੀ ਦਿੰਦਾ ਜੀ ਅਤੇ ਮੈਨੂੰ ਪਤਾ ਮੈਨੂੰ ਪਤਾ ਲੱਗਿਆ ਜੀ ਵੀ ਵੀ ਤੁਸੀਂ ਮੋਹਾਲੀ ਦੇ ਵਿੱਚ ਰਹਿੰਦੇ ਹੋ ਅਤੇ ਵੀ ਇੱਥੇ ਬਹੁਤ ਵਧੀਆ ਵਧੀਆ ਮਠਿਆਈ ਦੀਆਂ ਦੁਕਾਨਾਂ ਮਸ਼ਹੂਰ ਹਨ ਜਿਹੜੀਆਂ ਕਿ ਮਸ਼ਹੂਰ ਹੈ ਜੀ ਹਾਂ ਤੁਸੀਂ ਮੈਨੂੰ ਇਸ ਬਾਰੇ ਕੋਈ ਅਤੇ ਤੁਹਾਨੂੰ ਇਸ ਬਾਰੇ ਕਾਫ਼ੀ ਜਾਣਕਾਰੀ ਹੈ ਜੀ ਮੇਰੇ ਭਾਬੀ ਤੁਹਾਡੇ ਦੋਸਤ ਹੈ ਜੀ ਉਹਨਾਂ ਤੋਂ ਮੈਨੂੰ ਤੁਹਾਡਾ ਨੰਬਰ ਮਿਲਿਆ ਬਾਈ

ਮੈਨੂੰ ਮੋਹਾਲੀ ਦੀਆਂ ਮਸ਼ਹੂਰ ਮਠਿਆਈਆਂ ਦੀਆਂ ਕੁੱਝ ਦੁਕਾਨਾਂ ਬਾਰੇ ਤੁਸੀਂ ਮਾੜਾ ਜਿਹਾ ਦੱਸ ਸਕਦੇ ਹੋ ਜੀ ਠੀਕ ਹੈ ਜੀ ਠੀਕ ਹੈ ਜੀ ਕਿਆ ਇਹ ਜਿਹੜੇ ਮਤਲਬ ਕੀ ਦੁਕਾਨਾਂ ਵਾਲੇ ਕਿਆ ਮੈਨੂੰ ਵੀਡੀਓ ਬਣਾਉਣ ਲਈ ਮੇਰੇ ਚੈੱਨਲ ਲਈ ਮੈਨੂੰ ਪਰਮਿਸ਼ਨ ਦੇ ਦੇਣਗੇ ਠੀਕ ਹੈ ਜੀ ਤੁਸੀਂ ਨਾਲ਼ ਜਾ ਸਕਦੇ ਹੋ ਜੀ ਠੀਕ ਹੈ ਜੀ ਫਿਰ ਮੈਂ ਕੱਲ ਨੂੰ ਤੁਹਾਨੂੰ ਦਿਨੇ ਨੌ ਕੁ ਵਜੇ ਤੁਹਾਨੂੰ ਮੈਂ ਕੋਲ ਕਰ ਲਵਾਂਗਾ ਠੀਕ ਹੈ ਜੀ